ਤਕਰੀਬਨ ਅੱਜ ਤੋਂ ਤਿੰਨ ਦਿਨ ਪਹਿਲਾਂ ਬਰਸਾਤ ਹੋਣ ਕਾਰਨ ਸਾਡੇ ਪਿੰਡ ਵਿੱਚ ਹੜ੍ਹ ਆ ਗਿਆ ਇਸ ਕਾਰਨ ਹਵਾ ਹਨੇਰੀ ਚੱਲਣ ਕਾਰਨ ਸਾਡੇ ਆਲ਼ੇ ਦੁਆਲ਼ੇ ਦੇ ਖੰਭੇ ਗਿਰ ਗਏ ਇਸ ਕਾਰਨ ਬਿਜਲੀ ਚਲੀ ਗਈ ਬਿਜਲੀ ਜਾਣ ਕਾਰਨ ਸਾਡੇ ਪਿੰਡ ਵਿੱਚ ਪਾਣੀ ਵੀ ਨਹੀਂ ਆਇਆ ਇਸ ਕਾਰਨ ਸਾਡੀਆਂ ਟੈਂਕੀਆਂ ਵੀ ਖਾਲੀ ਹੋ ਗਈਆਂ ਸਾਨੂੰ ਪੀਣ ਵਾ ਨਹਾਉਣ ਵਾਲਾ ਪਾਣੀ ਤਾਂ ਕੀ ਸਾਨੂੰ ਪੀਣ ਵਾਲਾ ਪਾਣੀ ਵੀ ਨਾ ਬਚਿਆ